ਪੰਜਾਬ ਦੇ ਵਿੱਚ ਸਿਹਤ ਸਮੱਸਿਆ ਸਿਹਤ ਸਹੂਲਤਾਂ ਦੇ ਫੰਡ ਦੇ ਸੰਬੰਧ ਵਿੱਚ ਜਦੋਂ ਇੱਥੇ ਜਿਹੜਾ ਫੰਡ ਹੈ ਉਹ ਪੰਜਾਬ ਸਰਕਾਰ ਵੱਲੋਂ ਅਤੇ ਸੈਂਟਰ ਸਰਕਾਰਾਂ ਵੱਲੋਂ ਜੋ ਸਿਹਤ ਦੀਆਂ ਸਹੂਲਤਾਂ ਹੈ ਉਸ ਦੇ ਲਈ ਫੰਡ ਦਾ ਰਾਖਵਾਂਕਰਨ ਕੀਤਾ ਜਾਂਦਾ ਹੈ ਉਹ ਪੈਸਾ ਜੋ ਹੈ ਉਹ ਵੱਖ ਵੱਖ ਸਮੇਂ ਦੇ ਦੌਰਾਨ ਆਪਣੇ ਜੋ ਸਾਡੇ ਸਿਹਤ ਦੇ ਖੇਤਰ ਹੈ ਉਸ ਦੇ ਫੰਡ ਦੇ ਵਿੱਚ ਜਮ੍ਹਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਕਰਕੇ ਫੰਡ ਦੇ ਜਿਹੜੇ ਰੂਪ ਹੈ ਉਹ ਕਈ ਤਰ੍ਹਾਂ ਦੇ ਹੈਗੇ ਹੈ ਜਿਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਜੱਚਾ ਬੱਚਾ ਦੇ ਲਈ ਪੈਸਾ ਅਤੇ ਜੱਚਾ ਬੱਚਾ ਦੇ ਖ਼ਾਦ ਖੁਰਾਕ ਦੇ ਲਈ ਪੈਸਾ ਉਸ ਤੋਂ ਇਲਾਵਾ ਬਜ਼ੁਰਗਾਂ ਬਜ਼ੁਰਗ ਔਰਤਾਂ ਅਤੇ ਬਜ਼ੁਰਗ ਬੰਦਿਆਂ ਦੇ ਲਈ ਜਿਹੜਾ ਖ਼ਾਦ ਸ ਆਪਣੇ ਸਿਹਤ ਦੀ ਸਮੱਸਿਆਵਾਂ ਦੇ ਸੰਬੰਧ ਵਿੱਚ ਉਹਨਾਂ ਨੂੰ ਉਹ ਪੈਸਾ ਦੇਣਾ ਅਤੇ ਇਸ ਤੋਂ ਇਲਾਵਾ ਜਿਹੜੇ ਚੈਰੀਟੇਬਲ ਹੋਸਪਿਟਲ ਹੈਗੇ ਹੈ ਜਿੱਥੇ ਕਿ ਲੱਖਾਂ ਦੇ ਇਲਾਜ ਜਿਹੜੇ ਹੈ ਉਹ ਬਹੁਤ ਹੀ ਘੱਟ ਪੈਸਿਆਂ ਦੇ ਖਰਚ ਦੇ ਕੀਤੇ ਜਾਂਦੇ ਹੈ ਜਿਵੇਂ ਸਾਡੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਨਾਲ ਮੋਹਾਲੀ ਇੱਕ ਤੇਰਾ ਤੇਰਾ ਨਾਮ ਦਾ ਹੋਸਪਿਟਲ ਹੈ ਜਿੱਥੇ ਕਿ ਇਲਾਜ ਜਿਹੜਾ ਹੈਗਾ ਹੈ ਤੇਰ੍ਹਾਂ ਰੁਪਇਆ ਦੇ ਵਿੱਚ ਹੀ ਕੀਤਾ ਜਾਂਦਾ ਹੈ ਔਰ ਉੱਥੇ ਜਿਹੜੇ ਟੈਸਟ ਹੈ ਉਹ ਚਾਹੇ ਸਰੀਰ ਦੇ ਅਕੋਰਡਿੰਗ ਕਿਸੇ ਤਰ੍ਹਾਂ ਦੇ ਵੀ ਟੈਸਟ ਹੈ ਚਾਹੇ ਉਹ ਲੀਵਰ ਹੈ ਕਿਡਨੀ ਹੈ ਆਪਣੇ ਇਸ ਤੋਂ ਇਲਾਵਾ ਕੋਈ ਹੋਰ ਸਿਰ ਦੇ ਕੋਈ ਟੈਸਟ ਹੈ ਐਮ ਆਰ ਆਈ ਹੈ ਉਹ ਵੀ ਬਹੁਤ ਹੀ ਘੱਟ ਰੇਟਾਂ 'ਤੇ ਪੰਜਾਹ ਰੁਪਏ ਐਮ ਆਰ ਆਈ ਇਸ ਤਰ੍ਹਾਂ ਦੇ ਰੇਟ ਜਿਹੜੇ ਹੈਗੇ ਰੇਟਾਂ 'ਤੇ ਕੀਤੇ ਜਾਂਦੇ ਹੈ ਔਰ ਚੈਰੀਟੇਬਲ ਟਰੱਸਟਾਂ ਦੇ ਹੋਸਪੀਟਲਾਂ ਦੁਆਰਾ ਜਿਹੜਾ ਲੋਕਾਂ ਨੂੰ ਕਾਫ਼ੀ ਰਾਹਤ ਜਿਹੜੀ ਹੈ ਇਲਾਜ ਦੇ ਦੌਰਾਨ ਮਿਲਦੀ ਹੈ ਇਸ ਕਰਕੇ ਜਿਹੜੇ ਹੋਸਪਿਟਲਸ ਹੈਗੇ ਹੈ ਸ ਸਾਡੇ ਚੈਰੀਟੇਬਲ ਹੋਸਪਿਟਲ ਹੈ ਇਹਨਾਂ ਨੂੰ ਲੋਕ ਬੜਾਵਾ ਦੇ ਰਹੇ ਆ ਜਿੱਥੇ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਘੱਟ ਪੈਸਿਆਂ ਦੇ ਵਿੱਚ ਲੋਕਾਂ ਦੀ ਜਿਹੜੀ ਸਿਹਤ ਹੈ ਉਹ ਉਸ ਦੀ ਖਿਆਲ ਰੱਖਿਆ ਜਾਵੇ ਸਿਹਤ ਨੂੰ ਠੀਕ ਅਤੇ ਤੰਦਰੁਸਤ ਰੱਖਿਆ ਜਾਵੇ ਇਸ ਦੇ ਨਾਲ ਹੀ ਕਈ ਅਲੱਗ ਅਲੱਗ ਜਿਹੜੇ ਹੋਰ ਛੋਟੇ ਹਸਪਤਾਲ ਹੈਗੇ ਹੈ ਉਹ ਵੀ ਜੋ ਚੈਰੀਟੇਬਲ ਟਰੱਸਟਾਂ ਦੇ ਹੈਗੇ ਹੈ ਉੱਥੇ ਵੀ ਇਸੇ ਤਰ੍ਹਾਂ ਦੀਆਂ ਜਿਹੜੀ ਸੁਵਿਧਾਵਾਂ ਉਹ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹੈ ਤਾਂ ਜੋ ਕਿਸੇ ਤਰੀਕੇ ਦੀ ਕਿਸੇ ਨੂੰ ਕੋਈ ਮਰੀਜ਼ ਨੂੰ ਦਿੱਕਤ ਨਾ ਆਵੇ ਇਸ ਦੇ ਇਲਾਵਾ ਉੱਥੇ ਮਰੀਜ਼ਾਂ ਦੇ ਰਹਿਣ ਸਹਿਣ ਦੇ ਲਈ ਵੀ ਪ੍ਰਬੰਧ ਹੈਗੇ ਆ ਜਿੱਥੇ ਉਹਨਾਂ ਦੇ ਖਾਣੇ ਦਾ ਪ੍ਰਬੰਧ ਅਤੇ ਉਹਨਾਂ ਦੇ ਲਈ ਬੈਡਾਂ ਦਾ ਬਿਸਤਰਿਆਂ ਦਾ ਪ੍ਰਬੰਧ ਅਤੇ ਉਸ ਦੇ ਸੰਬੰਧ ਵਿੱਚ ਵੀ ਫੰਡ ਜਿਹੜਾ ਹੈ ਉਹਨਾਂ ਨੂੰ ਮਿਲਦਾ ਹੈ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਹੈ ਇਹਦੇ ਇਸ ਤੋਂ ਇਲਾਵਾ ਕਈ ਸਾਡੇ ਹੋਸਪਿਟਲ ਅਜਿਹੇ ਨੇ ਜਿੱਥੇ ਕਿ ਮਰੀਜ਼ ਨੇ ਸਿਰਫ਼ ਆਪਣਾ ਆਹ ਆਧਾਰ ਕਾਰਡ ਜਾਂ ਸਰਕਾਰ ਵੱਲੋਂ ਬਣਾਏ ਗਏ ਕਾਰਡ ਹੀ ਚਲਦੇ ਹੈ ਜਿੱਥੇ ਕਿ ਲੱਖਾਂ ਦਾ ਇਲਾਜ ਜਿਹੜਾ ਹੈਗਾ ਹੈ ਮ ਮਰੀਜ਼ ਦਾ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਹੋ ਜਾਂਦਾ ਹੈ ਅਤੇ ਇਹਦੇ ਨਾਲ ਕੀ ਹੈ ਵੀ ਜਿਹੜੇ ਲੋਕਾਂ ਦੀ ਜੀਵਨ ਸ਼ੈਲੀ ਦੇ ਵਿੱਚ ਸਿਹਤ ਸਿਹਤ ਸ ਸਿਹਤ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਤੋਂ ਰਾਹਤ ਮਿਲਦੀ ਹੈ